ਮੈਂ ਭਾਰਤ ਭੂਸ਼ਨ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਮੈਨੂੰ ਪਤਾ ਲੱਗਿਆ ਸੀ ਕਿ ਔਨਲਾਈਨ ਆਰਡਰ 'ਤੇ ਖਾਣਾ ਮੰਗਵਾਇਆ ਜਾਂਦਾ ਮੈਂ ਸੋਚਿਆਂ ਮੈਂ ਵੀ ਪਰਿਵਾਰ ਨਾਲ ਅੱਜ ਬਾਹਰੋਂ ਖਾਣਾ ਮੰਗਵਾ ਕੇ ਅਤੇ ਖਾਵਾਂ

ਅਤੇ ਮੇਰਾ ਖਾਣਾ ਪਹਿ ਪਹਿਲੇ ਪਤੇ 'ਤੇ ਚੱਲ ਜਾਣਾ ਅਤੇ ਮੈਂ ਆਪਣਾ ਪਤਾ ਚੇਂਜ ਕਰਵਾਉਣਾ ਸੀ ਇਸ ਲਈ ਮੈਂ ਨਵੇਂ ਪਤੇ 'ਤੇ ਉਸ ਖਾਣੇ ਨੂੰ ਮੰਗਵਾਉਣਾ ਚਾਹੁੰਦਾ ਹਾਂ ਜੇ ਤੁਹਾਡੀ ਅਨੁਮਤੀ ਹੋਵੇ ਤਾਂ ਮੈਂ ਇਹ ਨਵਾਂ ਪਤਾ ਜਿਹੜਾ ਕਿ ਗੁਰਦਾਸਪੁਰ ਗਲੀ ਨੰਬਰ ਪੰਜ ਅਤੇ ਮੁਹੱਲਾ ਸ਼ੇਖਾਂ ਦਾ ਅਤੇ ਕੀ ਇਹ ਪਤੇ 'ਤੇ ਉਹ ਖਾਣਾ ਆ ਸਕਦਾ ਜੇ ਆ ਸਕਦਾ ਹੈ ਤਾਂ ਮੈਂ ਉਹਦੀ ਐਡਵਾਂਸ ਪੇਮੈਂਟ ਔਨਲਾਈਨ ਪੇ ਕਰ ਦਿੰਦਾ ਹਾਂ ਸਰ ਤੁਸੀਂ ਰਿਪਲਾਈ ਕਰਕੇ ਜ਼ਰੂਰ ਦੱਸਿਓ ਕਿ ਇਹ ਖਾਣਾ ਇੱਥੇ ਪਹੁੰਚ ਜਾਵੇਗਾ ਮੇਰਾ ਨਵਾਂ ਨੰਬਰ ਵੀ ਐਡ ਕਰ ਲਓ ਜਿਹੜਾ ਕਿ ਛੇ ਦੋ ਚਾਰ ਪੰਜ ਸੱਤ ਚਾਰ ਡਬਲ ਸੈ ਡਬਲ ਸੈਵਨ ਹੈ ਜੋ ਕਿ ਇਸ ਸਮੇਂ ਉਪਲੱਬਧ ਹੈ ਇਸ 'ਤੇ ਕੋਲ ਕਰਕੇ ਮੈਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ